ਹਰ ਪ੍ਰਾਂਤ ਕੋਲ ਆਪਣਾ ਸੰਗੀਤਕ ਸਾਜ ਹੈ ਆਪਣਾ ਅਲੱਗ ਲੋਕ ਨਾਚ ਹੈ ਉਸ ਤਰ੍ਹਾਂ ਪੰਜਾਬ ਦਾ ਵੀ ਅਲੱਗ ਸੰਗੀਤਕ ਸਾਜ ਹੈ ਉਸਦਾ ਅਲੱਗ ਲੋਕ ਨਾਚ ਹੈ ਜਿਵੇਂ ਕਿ ਪੰਜਾਬ ਦਾ ਲੋਕ ਨਾਚ ਭੰਗੜਾ ਉਹਦੇ ਵਿੱਚ ਅਲੱਗ ਅਲੱਗ ਸੰਗੀਤਕ ਸਾਜ ਇਸਤੇਮਾਲ ਕੀਤੇ ਜਾਂਦੇ ਹਨ ਅਤੇ ਉਸ ਵਿੱਚ ਜ਼ਿਆਦਾਤਰ ਸੰਗੀਤਕ ਸਾਜ ਹੁੰਦੇ ਆ ਜਿਵੇਂ ਕਿ ਢੋਲਕੀ ਘੜਾ ਤੁੰਬੀ ਅਤੇ ਚਿਮਟਾ ਇਹਦੀ ਵਰਤੋਂ ਨਾਲ ਜਿਹੜਾ ਭੰਗੜੇ ਦਾ ਸੰਗੀਤਕ ਸਾਜ ਹੈ ਉਹ ਬਹੁਤ ਹੀ ਜੋਸ਼ੀਲਾ ਬਣਦਾ ਸੁਰੀਲਾ ਬਣਦਾ ਹੈ ਜਿਹਦੇ ਨਾਲ ਭੰਗੜੇ ਕਰਨ ਵਾਲੇ 'ਚ ਵੀ ਜੋਸ਼ ਆਉਂਦਾ ਹੈ ਅਤੇ ਸੁਣਨ ਦੇਖਣ ਵਾਲੇ ਨੂੰ ਵੀ ਮਨੋਰੰਜਨ ਸ਼ੀਲ ਬਣਾਉਂਦਾ ਹੈ ਜਿਹਦੇ ਕਰਕੇ ਜਿਹੜਾ ਭੰਗੜਾ ਹੈ ਉਸਦਾ ਅਲੱਗ ਅਲੱਗ ਰੂਪ ਇਹਨਾਂ ਸਾਜਾਂ ਨਾਲ ਅਲੱਗ ਅਲੱਗ ਰੂਪ ਬਣਦੇ ਹਨ ਉਹਨਾਂ ਦੀ ਅਲੱਗ ਅਲੱਗ ਤਰੀਕੇ ਬਣਦੇ ਹਨ ਅਤੇ ਉਸ ਤਰ੍ਹਾਂ ਜਿਵੇਂ ਪੰਜਾਬ ਦੇ ਗੁਰਦੁਆਰਿਆਂ ਵਿੱਚ ਗੁਰਬਾਣੀ ਬੋਲੀ ਜਾਂਦੀ ਹੈ ਗੁਰਬਾਣੀ ਬੋਲਣ ਲਈ ਤਬਲਾ ਹਾਰਮੋਨੀਅਮ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹਨਾਂ ਨਾਲ ਜਿਹੜਾ ਗੁਰਬਾਣੀ ਦਾ ਸਾਜ ਹੈ ਉਹ ਅਲੱਗ ਰੂਪ ਨਾਲ ਆਉਂਦਾ ਹੈ ਅਤੇ ਬਹੁਤ ਹੀ ਸੁਰੀਲਾ ਬਣਦਾ ਹੈ ਜਿਹਦੇ ਨਾਲ ਸੁਣਨ ਵਾਲੇ ਨੂੰ ਮਨ 'ਚ ਸ਼ਾਂਤੀ ਆਉਂਦੀ ਹੈ ਸਕੂਨ ਮਿਲਦਾ ਹੈ ਗੁਰਬਾਣੀ ਦਾ ਰਸ ਇੰਨਾ ਮਿੱਠਾ ਹੋ ਜਾਂਦਾ ਇਹਨਾਂ ਸਾਜਾਂ ਦੀ ਵਰਤੋਂ ਕਰਨ ਨਾਲ ਕਿ ਸੁਣਨ ਵਾਲਾ ਆਪਣੇ ਆਪ ਨੂੰ ਮਤਲਬ ਬਹੁਤ ਹੀ ਵਧੀਆ ਮਹਿਸੂਸ ਕਰਦਾ ਹੈ ਅਤੇ ਜਿਵੇਂ ਆਪਣੇ ਪ੍ਰਸਿੱਧ ਸੀਗੇ ਅਮਰ ਸਿੰਘ ਚਮਕੀਲਾ ਬਹੁਤ ਹੀ ਪ੍ਰਸਿੱਧ ਸੰਗੀਤਕਾਰ ਸਨ ਜਿਨ੍ਹਾਂ ਨੇ ਪਹਿਲੀ ਵਾਰ ਆਪਣੇ ਸੰਗੀਤ ਵਿੱਚ ਤੂੰਬੀ ਦੀ ਵਰਤੋਂ ਕੀਤੀ ਸੀ ਜਿਨ੍ਹਾਂ ਨਾਲ ਉਹਨਾਂ ਦੇ ਸੰਗੀਤ ਬਹੁਤ ਹੀ ਪ੍ਰਸਿੱਧ ਹੋਇਆ ਸੀ ਅਤੇ ਬਹੁਤ ਹੀ ਸੁਰੀਲਾ ਅਤੇ ਜੋਸ਼ੀਲਾ ਸੀਗਾ ਇਹਨਾਂ ਸੰਗੀਤਾਂ ਕਰਕੇ ਹੀ ਭੰਗੜਾ ਵੀ ਬਹੁਤ ਮਸ਼ਹੂਰ ਹੋ ਗਿਆ ਸੀ ਉਹਨਾਂ ਦੇ ਸੰਗੀਤ ਪੂਰੇ ਪੰਜਾਬ ਵਿੱਚ ਬਹੁਤ ਮਸ਼ਹੂਰ ਹੋਇਆ ਸੀ ਬਹੁਤ ਹੀ ਮਸ਼ਹੂਰ ਪ੍ਰਸਿੱਧ ਸੰਗੀਤਕਾਰ ਬਣੇ ਸਨ ਇਹ ਸਾਜ ਦੀ ਵਰਤੋਂ ਨਾਲ ਜਿਹੜੇ ਪੰਜਾਬੀ ਸੰਗੀਤ ਹਨ ਉਹ ਬਹੁਤ ਹੀ ਜੋਸ਼ੀਲੇ ਪਨ ਜੋਸ਼ੀਲੇ ਹੁੰਦੇ ਹਨ ਅਤੇ ਬਹੁਤ ਹੀ ਸੁਰੀਲੇ ਵੀ ਹੁੰਦੇ ਹਨ ਜਿਹਦੇ ਕਰਕੇ ਸੁਣਨ ਵਾਲੇ ਵਿੱਚ ਅਲੱਗ ਉਤਸ਼ਾਹ ਪੈਦਾ ਹੁੰਦਾ ਹੈ ਸੁਣਨ ਵਾਲਾ ਆਪਣੇ ਆਪ ਨੂੰ ਬਹੁਤ ਹੀ ਵਧੀਆ ਮਹਿਸੂਸ ਕਰਦਾ ਹੈ